ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਖੇਡ ਦੀਆਂ ਕੰਪਨੀਆਂ ਹਨ ਜੋ ਖੇਡ ਦੇ ਵਿਕਾਸ ਵਿੱਚ ਖਿਡਾਰੀਆਂ ਨੂੰ ਸਾਹਿਤ ਕਰਦੀਆਂ ਹਨ ਇਸ ਵਿੱਚ ਇੱਕ ਕੰਪਨੀ ਜਿਸ ਦਾ ਨਾਮ ਗਾਂਧੀ ਸਪੋਰਟਸ ਬ੍ਰਾਂਚ ਹੈ ਇਹ ਕੰਪਨੀ ਨੇ ਬਹੁਤ ਸਾਰੇ ਕੋਚਿੰਗ ਸੈਂਟਰ ਖੋਲੇ ਹਨ ਜਿਸ ਵਿੱਚ ਖਿਡਾਰੀਆਂ ਨੂੰ ਅਲੱਗ ਅਲੱਗ ਖੇਡਾਂ ਦਾ ਖੇਡਾਂ ਦੀ ਟ੍ਰੇਨਿੰਗ ਮਿਲਦੀ ਹੈ ਇਸ ਦੇ ਨਾਲ ਨਾਲ ਉਹਨਾਂ ਦੇ ਖਾਣ ਪੀਣ ਦਾ ਵੀ ਧਿਆਨ ਰੱਖਦੇ ਹਨ ਅਤੇ ਉਹ ਕੋਚਿੰਗ ਸੈਂਟਰ ਵਿੱਚ ਮੈਡੀਕਲ ਸਟੋਰ ਵੀ ਉਪਲੱਬਧ ਹੁੰਦੇ ਹਨ ਜਿਸ ਲਈ ਖਿਡਾਰੀਆਂ ਨੂੰ ਕੋਈ ਖੇਡ ਦੇ ਦੌਰਾਨ ਸੱਟ ਲੱਗਣ ਜਾਂ ਹੋਰ ਸਮੱਸਿਆ ਪੈ ਜਾਣ ਕਾਰਨ ਤੁਰੰਤ ਇਲਾਜ ਮਿਲਦਾ ਹੈ ਇਹ ਕੰਪਨੀਆਂ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਾਂ ਕਰਵਾਉਂਦੀਆਂ ਹਨ ਜਿਸ ਵਿੱਚ ਖਿਡਾਰੀਆਂ ਨੂੰ ਜਿੱਤਣ 'ਤੇ ਇਨਾਮ ਦੀ ਇਨਾਮ ਵਿੱਚ ਪੈਸੇ ਮੈਡਲ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਸਾਈਕਲ ਮੋਟਰਸਾਈਕਲ ਗੱਡੀਆਂ ਆਦਿ ਸ਼ਾਮਿਲ ਕਰਕੇ ਖਿਡਾਰੀਆਂ ਦੀ ਮਦਦ ਕਰਦੀਆਂ ਹਨ